ਹੈਲ ਹੈਲੋ ਮੈਮ ਗੁਡ ਈਵਨਿੰਗ ਮੈਮ ਮੈਮ ਮੈਂ ਜਸਪ੍ਰੀਤ ਬੋਲ ਰਹੀ ਹਾਂ ਮੈਮ ਮੈਂ ਤੁਹਾਡੇ ਕੋਲ ਯੋ ਯੋਗਾ ਬਾਰੇ ਪੁੱਛਣਾ ਸੀ ਕਿ ਮੇਰੇ ਨਾ ਮੇਰਾ ਕਮਰ ਦਰਦ ਬਹੁਤ ਹੁੰਦੀ ਆ ਅਤੇ ਮੇਰੇ ਅੰਦਰ ਜਿਹੜੀਆਂ ਹੈਗੀਆਂ ਮੈਂ ਲੱਤਾਂ ਵੀ ਬਹੁਤ ਦਰਦ ਹੁੰਦੀਆਂ ਨੇ ਸਰੀਰ ਦੇ ਵਿੱਚ ਆਉਂਦੀ ਥੋੜ੍ਹਾ ਜਿਹਾ ਆਪਾਂ ਮਾਨਸਿਕ ਤੌਰ 'ਤੇ ਵੀ ਕਈ ਵਾਰ ਥਕਾਵਟ ਆ ਜਾਂਦੀ ਮੈਮ ਤੁਸੀਂ ਕੋਈ ਮੈਨੂੰ ਦੱਸ ਦੋ ਯੋਗ ਕਿਹੜੇ ਕਿਹੜੇ ਆਸਣ ਕਰਨੇ ਚਾਹੀਦੇ ਹੈ ਅਤੇ ਉਹਨਾਂ ਦਾ ਮੈਨੂੰ ਕੀ ਫਾਇਦਾ ਹੋਵੇਗਾ ਹਾਂਜੀ ਮੈਮ ਡਾਇਟ ਤਾਂ ਸਹੀ ਹੈ ਨੋਰਮਲ ਆਪਾਂ ਜੋ ਰੋਟੀ ਪਾਣੀ ਖਾਂਦੇ ਹਾਂ ਹਾਂਜੀ ਮੈਮ ਹਾਂਜੀ ਮੈਮ ਓਕੇ ਮੈਮ ਮੈਮ ਯੋਗਾ ਨਾਲ ਜਦੋਂ ਮੈਂ ਡੇਲੀ ਯੋਗਾ ਕਰਦੀ ਹਾਂ ਤਾਂ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਏਗੀ ਹਾਂਜੀ ਮੈਮ ਮੈਮ ਇਹ ਕਿੰਨੇ ਕੁ ਟਾਈਮ ਤੱਕ ਆਪਾਂ ਨੂੰ ਕਰਨਾ ਚਾਹੀਦਾ ਕਰਨਾ ਮਤਲਬ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਹਾਂਜੀ ਮੈਮ ਓਕੇ ਮੈਮ ਅਤੇ ਮੈਂ ਓਕੇ ਮੈਮ ਮੈਮ ਕੀ ਪੁੱਛਣਾ ਸੀ ਕਿ ਆਪਾਂ ਸਵੇਰ ਟਾਈਮ ਮਤਲਬ ਖਾਣਾ ਖਾਣ ਤੋਂ ਪਹਿਲਾਂ ਕਰਨਾ ਜਾਂ ਬਾਅਦ 'ਚ ਵੀ ਕਰ ਸਕਦੇ ਓਕੇ ਮੈਮ ਮੈਮ ਤਾਂ ਕਿ ਬੈਨੀਫਿਟ ਹੋਣਗੇ ਮੇਰੇ ਸਰੀਰ ਮਤਲਬ ਮੇਰੀ ਬੋਡੀ ਦੇ ਵਿੱਚ ਜਿਵੇਂ ਮੇਰੀ ਜਿਹੜੀ ਪ੍ਰੋਬਲਮ ਆ ਉਹ ਠੀਕ ਹੋ ਜੇਗੀ ਹੋਰ ਵੀ ਮੈਨੂੰ ਬੈਨੀਫਿਟਸ ਹੋਣਗੇ ਜਾਂ ਫਿਰ ਨਹੀਂ ਹਾਂਜੀ ਮੈਮ ਓਕੇ ਮੈਮ ਹਾਂਜੀ ਮੈਮ ਠੀਕ ਹੈ ਹਾਂਜੀ ਮੈਮ ਮੈਮ ਬਸ ਹਾਂਜੀ ਮੈਮ ਮੈਂ ਇਸੇ ਕਰਕੇ ਮੈਂ ਕਿਹਾ ਮੈਮ ਨੂੰ ਫੋਨ ਕਰਕੇ ਥੈਂਕ ਯੂ ਮੈਮ ਤੁਸੀਂ ਮੈਨੂੰ ਇਹਨਾਂ ਕੁਝ ਦੱਸਿਆ ਮੈਂ ਜ਼ਰੂਰ ਤੁਹਾਡੇ ਇੰਸਟਰਕਸ਼ਨ ਨੂੰ ਫੋਲੋ ਕਰਾਂਗੀ ਹਾਂਜੀ ਥੈਂਕ ਯੂ ਮੈਮ